ਹਾਂਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆਪਣੀ ਇੱਕ ਹੋਬੀ ਬਾਰੇ ਜੋ ਕਿ ਹੈ ਦੌੜਨਾ ਮੈਨੂੰ ਦੌੜਨਾ ਬਹੁਤ ਪਸੰਦ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਅਗਰ ਆਪਾਂ ਨੂੰ ਤੰਦਰੁਸਤ ਰਹਿਣਾ ਹੈ ਤਾਂ ਆਪਾਂ ਨੂੰ ਆਪਣੇ ਜੀਵਨ ਵਿੱਚ ਦੌੜਨਾ ਬਹੁਤ ਜ਼ਰੂਰੀ ਹੈ ਮੈਂ ਸਵੇਰੇ ਅਤੇ ਸ਼ਾਮ ਦੋਨੋਂ ਟਾਈਮ ਦੋੜਨ ਜਾਂਦਾ ਹਾਂ ਮੇਰਾ ਜਿਹੜਾ ਸ਼ੈਡਿਊਲ ਹੈ ਸਵੇਰੇ ਦੌੜਨ ਦਾ ਉਹ ਮੈਂ ਸਵੇਰੇ ਪੰਜ ਵਜੇ ਉੱਠ ਕੇ ਗਰਾਊਂਡ ਦੌੜਨ ਜਾਂਦਾ ਹਾਂ ਜਿਹਦੇ ਨਾਲ ਮੇਰਾ ਸਾਰਾ ਦਿਨ ਮੈਂ ਅਗਰ ਦੋ ਘੰਟੇ ਦੌੜਦਾ ਤਾਂ ਮੇਰਾ ਸਾਰਾ ਦਿਨ ਫਰੈਸ਼ ਰਹਿੰਦਾ ਮੈਂ ਕੰਮ 'ਤੇ ਬਿਲਕੁਲ ਫਰੈਸ਼ ਆਪਦੇ ਤਨਦੇਹੀ ਨਾਲ ਕੰਮ ਕਰ ਪਾਉਂਦਾ ਮੈਨੂੰ ਬਿਲਕੁਲ ਆਲਸ ਮਹਿਸੂਸ ਨਹੀਂ ਹੁੰਦਾ ਅਤੇ ਮੈਂ ਹੁਣ ਦੱਸਣਾ ਚਾਹਾਂਗਾ ਤੁਹਾਨੂੰ ਬਈ ਜੋ ਮੈਂ ਦੌੜਦੇ ਸਮੇਂ ਜਿਹੜਾ ਸੰਗੀਤ ਹੈ ਉਹ ਮੈਂ ਮੈਨੂੰ ਹਿੰਦੀ ਸੰਗੀਤ ਸੁਣਨਾ ਬਹੁਤ ਪਸੰਦ ਹੈ ਜਿਹਦੇ ਨਾਲ ਮੇਰਾ ਮਨ ਹੈ ਉਹ ਇਕਾਗਰ ਰਹਿੰਦਾ ਹੈ ਮੈਨੂੰ ਜਿਹੜਾ ਥਕਾਵਟ ਤਾਂ ਮਹਿਸੂਸ ਹੁੰਦੀ ਹੈ ਬਟ ਇੱਕ ਮੈਂਟਲੀ ਥਕਾਵਟ ਜੋ ਆਪਾਂ ਦੌੜਦੇ ਸਮੇਂ ਆਪਾਂ ਨੂੰ ਹੁੰਦੀ ਹੈ ਉਹ ਮੈਂਟਲੀ ਥਕਾਵਟ ਤੋਂ ਮੈਂ ਸੰਗੀਤ ਸੁਣਨ ਕਾਰਨ ਉਹ ਦੂਰੀ ਬਣ ਬਣੀ ਰਹਿੰਦੀ ਹੈ ਅਤੇ ਉਸ ਤੋਂ ਇਲਾਵਾ ਜਿਹੜਾ ਹੈ ਮੈਂ ਪਹਿਲਾਂ ਜਿਹੜਾ ਦੌੜਦੇ ਸਮੇਂ ਹੋਰ ਜਿਹੜੀਆਂ ਗੱਲਾਂ ਨੇ ਉਹ ਹੈ ਬਈ ਮੈਂ ਜਦੋਂ ਦੌੜਨ ਜਾਂਦਾ ਹਾਂ ਉਸ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਸਰੀਰ ਹੈ ਉਹ ਪੂਰਾ ਚੰਗੀ ਤਰ੍ਹਾਂ ਗਰਮ ਕਰਦਾ ਹਾਂ ਐਕਸਰਸਾਈਜ ਕਰਦਾ ਹਾਂ ਉੱਥੇ ਜਾ ਕੇ ਤਾਂ ਕਿ ਜਿਹੜਾ ਹੈ ਮੈਂ ਮੇਰਾ ਸਰੀਰ ਸੁਬਹਾ ਉੱਠਿਆ ਤਾਂ ਉਦੋਂ ਸਰੀਰ ਖੁੱਲ੍ਹ ਸਕੇ ਜਿਹਦੇ ਕਰਕੇ ਮੈਂ ਥੋੜ੍ਹਾ ਵਧੀਆ ਤਰੀਕੇ ਨਾਲ ਜਿਹੜੀਆਂ ਮੇਰੀਆਂ ਨਾੜਾਂ ਹਨ ਜਿਹੜੇ ਜਿਹੜੀਆਂ ਸਰੀਰ ਦੇ ਹੋਰ ਵੀ ਜਿਹੜੇ ਅੰਗ ਹਨ ਉਹ ਚੰਗੀ ਤਰ੍ਹਾਂ ਖੁੱਲ੍ਹ ਸਕਣ ਤਾਂ ਕਿ ਮੈਂ ਲੰਬਾ ਦੌੜ ਸਕਾਂ ਉਸ ਤੋਂ ਇਲਾਵਾ ਜੇ ਜਿਹੜੇ ਚੀਜ਼ਾਂ ਮੈਂ ਹੋਰ ਧਿਆਨ ਰੱਖਦਾ ਹਾਂ ਉਹ ਹਨ ਜਿਵੇਂ ਮੈਂ ਜਿਹੜਾ ਦੋੜਨ ਹੈ ਦੌੜਨਾ ਹੈ ਉਹ ਰੋਜ਼ ਅਲੱਗ ਅਲੱਗ ਤਰੀਕੇ ਦਾ ਜਿਵੇਂ ਕਈ ਵਾਰ ਮੈਂ ਲੰਬਾ ਦੌੜਨਾ ਹੈ ਕਈ ਵਾਰ ਮੈਂ ਸਪਰਿੰਟਾਂ ਲਾਉਣੀਆਂ ਅਤੇ ਇਸ ਤਰ੍ਹਾਂ ਬਈ ਸਰੀਰ ਨੂੰ ਇੱਕੋ ਤਰ੍ਹਾਂ ਦੀ ਖੁਰਾਕ ਦੇਣ ਤੋਂ ਥੋੜ੍ਹਾ ਗੁਰੇਜ਼ ਕਰਦਾਂ ਵੀ ਅਲੱਗ ਅਲੱਗ ਤਰ੍ਹਾਂ ਰੋਜ਼ ਅਲੱਗ ਤਰ੍ਹਾਂ ਦੀ ਐਕਸਰਸਾਈਜ਼ ਕਰਦਾਂ ਜਿਹਦੇ ਨਾਲ ਸਰੀਰ ਦਾ ਵੀ ਜਿਹੜਾ ਸੁਚਾਰੂ ਢੰਗ ਸ ਸਰੀਰ ਵੀ ਜਿਹੜਾ ਸੁਚਾਰੂ ਢੰਗ ਨਾਲ ਚੱਲ ਸਕੇ ਉਸ ਤੋਂ ਇਲਾਵਾ ਮੈਂ ਐਕਸਾਈਜ਼ ਕਰਨਾ ਹੋ ਗਿਆ ਅਤੇ ਹੋਰ ਰਨਿੰਗ ਤੋਂ ਬਾਅਦ ਵੀ ਐਕਸਾਈਜ ਕਰਨਾ ਪਾਣੀ ਦੀ ਭਰਪੂਰ ਮਾਤਰਾ ਪੀਣੀ ਪਰ ਪਾਣੀ ਰਨਿੰਗ ਦੌੜਦੇ ਟਾਈਮ ਪਰ ਪਾਣੀ ਭਰਪੂਰ ਪੀਂਦੇ ਹਾਂ ਤਾਂ ਕਿ ਜਿਹੜਾ ਪਾਣੀ ਦੀ ਘਾਟ ਸਰੀਰ ਨੂੰ ਨਾ ਲੱਗ ਸਕੇ